ਹਾਲ ਹੀ ਦੇ ਸਾਲਾਂ ਵਿੱਚ ਸੈਰ ਸਪਾਟਾ ਬਹੁਤ ਜ਼ਿਆਦਾ ਵੱਧ ਗਿਆ ਹੈ ਪਹਿਲਾਂ ਲੋਕਡਾਊਨ ਵਿੱਚ ਲੋਕ ਸਾਰੇ ਘਰ ਰਹਿੰਦੇ ਸਨ ਪਰ ਹੁਣ ਜਦੋਂ ਲੋਕਡਾਊਨ ਖੁੱਲ੍ਹ ਗਿਆ ਤਾਂ ਲੋਕ ਬਥੇਰੀ ਬਥੇਰੀ ਜਗ੍ਹਾ ਘੁੰਮਣਾ ਪਸੰਦ ਕਰਦੇ ਹਨ ਕਿਉਂਕਿ ਪਹਿਲਾਂ ਉਹ ਘਰ ਵਿੱਚ ਬੰਦੇ ਹੋਏ ਸਨ ਪਰ ਹੁਣ ਉਹ ਖੁੱਲ੍ਹੇ ਹੋ ਕੇ ਘੁੰਮਦੇ ਹਨ ਥਾਂ ਥਾਂ ਪਾਰਕ ਅਤੇ ਰੈਸਟੋਰੈਂਟ ਬਣੇ ਹਨ ਲੋਕ ਮੌਲ ਵਿੱਚ ਜਾਣਾ ਵੀ ਵਧੇਰੇ ਪਸੰਦ ਕਰਦੇ ਹਨ ਅਤੇ ਉੱਥੋਂ ਦਾ ਖਾਣਾ ਪੀਣਾ ਅਤੇ ਘੁੰਮਣਾ ਫਿਰਨਾ ਵੀ ਪਸੰਦ ਕਰਦੇ ਹਨ ਜ਼ਿਆਦਾਤਰ ਲੋਕ ਮੌਲ ਵਿੱਚੋਂ ਸ਼ੋਪਿੰਗ ਕਰਦੇ ਹਨ ਬਾਜ਼ਾਰ ਤੋਂ ਜ਼ਿਆਦਾ ਵੀ ਮੋਲ ਚੋਂ ਸ਼ੋਪਿੰਗ ਕਰਦੇ ਹਨ ਥਾਂ ਥਾਂ 'ਤੇ ਦੁਕਾਨਾਂ ਬਣ ਗਈਆਂ ਹਨ ਅਤੇ ਖਾਣ ਪੀਣ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਹੋ ਗਈਆਂ ਹਨ ਅਤੇ ਲੋਕ ਘੁੰਮਣਾ ਬਹੁਤ ਹੀ ਪਸੰਦ ਕਰਦੇ ਹਨ ਅਤੇ ਬਾਹਰ ਦੀਆਂ ਚੀਜ਼ਾਂ ਖਾਣਾ ਵੀ ਬਹੁਤ ਪਸੰਦ ਕਰਦੇ ਹਨ ਜਿਸ ਕਾਰਣ ਘਰ ਵਿੱਚ ਬਣਦੀਆਂ ਚੀਜ਼ਾਂ ਉਹ ਘੱਟ ਖਾਂਦੇ ਹਨ ਅਤੇ ਜਿਸ ਨਾਲ ਉਹ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਘਰ ਦੀਆਂ ਚੀਜ਼ਾਂ ਵੀ ਖਾਣ ਲੋਕਡਾਊਨ ਵਿੱਚ ਉਹ ਘਰ ਚੀਜ਼ਾਂ ਬਣਾਉਂਦੇ ਸਨ ਖੁਦ ਚੀਜ਼ਾਂ ਬਣਾ ਕੇ ਖਾਂਦੇ ਹਨ ਪਰ ਲੋਕਡਾਊਨ ਤੋਂ ਬਾਅਦ ਉਹ ਬਹੁਤ ਸਾਰਾ ਘੁੰਮਣਾ ਫਿਰਨਾ ਅਤੇ ਬਾਹਰ ਪਾਰਕਾਂ ਵਿੱਚ ਘੁੰਮਦੇ ਹਨ ਅਤੇ ਬਾਹਰ ਦੀਆਂ ਗੰਦੀਆਂ ਮੰਦੀਆਂ ਚੀਜ਼ਾਂ ਖਾਂਦੇ ਹਨ ਅਤੇ ਸੈਰ ਸਪਾਟਾ ਵੀ ਬਹੁਤ ਜ਼ਿਆਦਾ ਕਰਦੇ ਹਨ ਸ਼ਾਮ ਨੂੰ ਡੇਲੀ ਉਹ ਸੈਰ ਲਈ ਨਿਕਲ ਜਾਂਦੇ ਹਨ ਅਤੇ ਰਾਤ ਨੂੰ ਉਹ ਵਾਪਿਸ ਆਉਂਦੇ ਹਨ ਕਈ ਵਾਰ ਤਾਂ ਸਵੇਰੇ ਸਵੇਰੇ ਵੀ ਸੈਰ ਸਪਾਟੇ ਵਿੱਚ ਜਾਂਦੀਆਂ ਹਨ ਜਨਾਨੀਆਂ ਜਾਂ ਸੈਰ ਸਪਾਟਾ ਕਰਨਾ ਵਧੀਆ ਗੱਲ ਹੈ ਪਰ ਇੰਨਾ ਵੀ ਨਹੀਂ ਕਿ ਤੁਸੀਂ ਬਾਹਰ ਦੀਆਂ ਚੀਜ਼ਾਂ ਖਾਵੋ ਅਤੇ ਬਿਮਾਰ ਹੋ ਜਾਵੋ ਸੈਰ ਕਰਨਾ ਸਾਡੀ ਸਿਹਤ ਲਈ ਚੰਗੀ ਹੁੰਦੀ ਹੈ ਸ਼ਾਮ ਦੀ ਅਤੇ ਸਵੇਰ ਦੀ ਸੈਰ ਬਹੁਤ ਚੰਗੀ ਹੁੰਦੀ ਹੈ ਪਰ ਮੌਲ ਵਿੱਚ ਵਧੇਰੇ ਘੁੰਮਣਾ ਪਸੰਦ ਕਰਦੇ ਲੋਕ ਬਾਹਰ ਦੀਆਂ ਚੀਜ਼ਾਂ ਖਾ ਕੇ ਬਿਮਾਰ ਹੋ ਜਾਂਦੇ ਹਨ ਜੋ ਕਿ ਬਹੁਤ ਹਾਨੀਕਾਰਕ ਹੈ ਅਤੇ ਇਸ ਲਈ ਸਾਨੂੰ ਸੈਰ ਵੀ ਕਰਨੀ ਚਾਹੀਦੀ ਹੈ ਪਰ ਬਾਹਰ ਦੀਆਂ ਚੀਜ਼ਾਂ ਘੱਟ ਖਾਣੀਆਂ ਚਾਹੀਦੀਆਂ ਹਨ ਸੈਰ ਸਪਾਟਾ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਇਸ ਨਾਲ ਸਿਹਤਮੰਦ ਜੋ ਬੀਮਾਰ ਹੁੰਦੇ ਹਨ ਉਹ ਵੀ ਸਿਹਤਮੰਦ ਹੋ ਜਾਂਦੇ ਹਨ ਧੰਨਵਾਦ